ਭਾਰਤ ਦੇ ਇਤਿਹਾਸ ਵਿੱਚ ਮੈਨੂੰ ਬਹੁਤ ਦਿਲਚਸਪੀ ਹੈ ਭਾਰਤ ਦਾ ਇਤਿਹਾਸ ਉਹ ਹੈ ਕਿ ਕਿਵੇਂ ਅਜ਼ਾਦੀ ਤੋਂ ਪਹਿਲਾਂ ਮੁਗਲਾਂ ਅਤੇ ਅੰਗਰੇਜਾਂ ਨੇ ਇਹਦੇ 'ਤੇ ਰਾਜ ਕੀਤਾ ਬਹੁਤ ਸਾਰੀਆਂ ਲੜਾਈਆਂ ਵੀ ਹੋਈਆ ਅਜ਼ਾਦੀ ਤੋਂ ਪਹਿਲਾਂ ਅਜ਼ਾਦੀ ਪਾਉਣ ਲਈ ਅਤੇ ਫਿਰ ਇਹਦੇ ਵਿੱਚ ਬਹੁਤ ਲੋਕੀ ਮਾਰੇ ਗਏ ਬਹੁਤ ਭਾਰਤ ਇੱਕ ਤਰ੍ਹਾਂ ਦਾ ਸੋਨੇ ਦੀ ਚਿੜੀ ਸੀਗੀ ਜਿਹਦੇ ਜਿਹਨੂੰ ਅੰਗਰੇਜ਼ਾਂ ਨੇ ਜਿਹਦੀ ਲੁੱਟ ਖੋਹ ਚੰਗੀ ਤਰ੍ਹਾਂ ਕੀਤੀ ਉਸ ਤੋਂ ਬਾਅਦ ਫਿਰ ਸਾਨੂੰ ਅਜ਼ਾਦੀ ਮਿਲੀ ਅਜ਼ ਅਜ਼ਾਦੀ ਦੇ ਨਾਲ ਦੇਸ਼ ਨੇ ਇੱਕ ਨਵਾਂ ਰੂਪ ਲਿਆ ਜਿਹਦੇ ਵਿੱਚ ਬਹੁਤ ਸਾਰੇ ਚੇਜਿੰਸ ਆਏ ਜਿਹੜਾ ਭਾਰਤ ਸੀਗਾ ਇੱਕ ਇੰਨਡਸਰੀਅਲ ਐਰਾ ਦੇ ਨਾਲ ਨਾਲ ਇੰਨਡਸਰੀਅਲ ਐਰਾ ਦੇ ਕਰਕੇ ਡਿਵੈਲਪਿੰਗ ਕੰਨਟਰੀ ਬਣ ਗਿਆ ਅਜ਼ਾਦੀ ਤੋਂ ਪਹਿਲਾਂ ਇਹ ਡਿਵੈਲਪਿੰਗ ਕੰਨਟਰੀ ਨਹੀਂ ਸੀਗੀ ਫਿਰ ਜਿੱਦਾਂ ਜਿੱਦਾਂ ਜਿੱਦਾਂ ਜਿੱਦਾਂ ਅਜ਼ਾਦੀ ਦਾ ਟਾਈਮ ਹੁੰਦਾ ਗਿਆ ਮਤਲਬ ਜਿਹੜਾ ਭਾਰਤ ਹੈ ਹੋਰ ਡਿਵੈਲਪ ਹੁੰਦਾ ਗਿਆ ਕਿਉਂਕਿ ਇੰਡਸਰੀਜ਼ ਬਣਦੀਆਂ ਗਈਆਂ ਨਵੀਂ ਨਵੀਂ ਚੀਜ਼ ਦੀ ਪ੍ਰੋਡਕਸ਼ਨ ਹੁੰਦੀ ਗਈ ਜਿਹਦੇ ਕਰਕੇ ਜਿਹੜੀ ਭਾਰਤ ਹੈ ਇਹ ਕੰਨਟਰੀ ਬਣਦਾ ਰਿਆ ਅਤੇ ਜਿਹੜਾ ਮਾਣ ਵਾਲਾ ਇਤਿਹਾਸਿਕ ਪਲ ਹੈ ਉਹ ਹੈ ਜਦੋਂ ਸਾਨੂੰ ਅਜ਼ਾਦੀ ਮਿਲੀ ਸੀਗੀ ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਵਿੱਚ ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਵਿੱਚ ਅਜ਼ਾਦੀ ਵੀ ਬਹੁਤ ਮੁਸ਼ਕਲ ਮਿਲੀ ਸੀ ਅੰਗਰੇਜ਼ਾਂ ਨਾਲ ਬਹੁਤ ਸਾਰੇ ਪੰਜਾਬ ਦੇ ਜਿਹੜੇ ਪੰਜਾਬ ਭਰ ਪੰਜਾਬ ਦੇ ਜਿਹੜੇ ਬੇਮਿਸਾਲ ਨੇਤਾਵਾਂ ਸੀਗੇ ਜਿਹਨਾਂ ਨੇ ਬਹੁਤ ਲੜਾਈਆਂ ਕਰਕੇ ਅਜ਼ਾਦੀ ਲਈ ਸੀ ਆਪਣੀ ਜਾਨ ਵੀ ਦਿੱਤੀ ਉਹਨਾਂ ਨੇ ਪੰਜਾਬ ਨੂੰ ਅਜ਼ਾਦ ਕਰਾਉਣ ਲਈ ਅਤੇ ਇਹਦੇ ਵਿੱਚ ਜਦੋਂ ਫਿਰ ਭਾਰਤ ਨੂੰ ਅਜ਼ਾਦੀ ਲਈ ਬਹੁਤ ਸਾਰੀਆਂ ਲੜਾਈਆਂ ਲੜੀਆਂ ਗਈਆਂ ਤਾਂ ਇਹਦਾ ਕੁਛ ਬੇਮਿਸਾਲ ਨੇਤਾਵਾਂ ਹਨ ਇਹਨਾਂ ਦੇ ਜਿੱਥੇ ਇਹਨਾਂ ਦੇ ਨਾਮ ਹੈਗੇ ਸ਼ਹੀਦ ਭਗਤ ਸਿੰਘ ਲਾਲਾ ਲਾਜਪਤ ਰਾਏ ਰਾਜਗੁਰੂ ਸੁਖਦੇਵ ਸੁਭਾਸ਼ ਚੰਦਰ ਬੋਸ